ਇੱਕ ਵਾਰ ਨਾ ਮੈਂ ਫਲਿੱਪਕਾਰਡ ਦੇ ਵਿੱਚ ਪ੍ਰੋਡਕਟਸ ਦੇਖ ਰਹੀ ਸੀ ਅਤੇ ਨਾ ਮੈਨੂੰ ਸਾਹਮਣੇ ਇੱਕ ਸੂਟ ਦਿਖਿਆ ਮੈਨੂੰ ਨਾ ਉਹ ਸੂਟ ਬੜਾ ਹੀ ਪਸੰਦ ਆਇਆ ਸੀ ਉਹ ਨਾ ਪਿਸਤੇ ਕਲਡ ਦਾ ਸੀ ਮੈਨੂੰ ਬਹੁਤ ਹੀ ਪਸੰਦ ਆਇਆ ਸੀ ਅਤੇ ਮੈਂ ਕਦੀ ਵੀ ਔਨਲਾਈਨ ਸ਼ੋਪਿੰਗ ਨਹੀਂ ਸੀ ਕੀਤੀ ਅਤੇ ਜਦੋਂ ਮੈਂ ਫਲਿੱਪਕਾਰਟ ਦੇ ਵਿੱਚ ਉਹ ਸੂਟ ਦੇਖਿਆ ਮੈਨੂੰ ਬੜਾ ਹੀ ਪਸੰਦ ਆਇਆ ਅਤੇ ਮੈਂ ਉਸ ਨੂੰ ਔਡਰ ਕੀਤਾ ਅਤੇ ਜਦੋਂ ਮੈਂ ਉਸ ਨੂੰ ਔਡਰ ਕੀਤਾ ਤਾਂ ਤਿੰਨ ਦਿਨਾਂ ਬਾਅਦ ਵਿੱਚ ਏ ਉਹਨਾਂ ਨੇ ਮੈਨੂੰ ਔਡਰ ਭੇਜ ਦਿੱਤਾ ਸੀ ਮੇਰੇ ਘਰ ਅਤੇ ਜਦੋਂ ਮੈਂ ਉਹ ਨੂੰ ਖੋਲ੍ਹ ਕੇ ਦੇਖਿਆ ਤਾਂ ਸੂਟ ਬੜਾ ਹੀ ਸੋਹਣਾ ਸੀ ਉਸ ਦਾ ਕੱਪੜਾ ਵੀ ਬੜਾ ਹੀ ਸੋਹਣਾ ਸੀਗਾ ਅਤੇ ਉਹ ਬਹੁਤ ਹੀ ਵਧੀਆ ਕੱਪੜਾ ਸੀ ਅਤੇ ਹਜੇ ਤੱਕ ਲੰਘ ਰਿਹਾ ਹੈ ਪਰ ਜਦੋਂ ਮੈਂ ਦੂਜੀ ਵਾਰ ਉਨ੍ਹਾਂ ਕੋਲ ਮੈਨੂੰ ਇੱਕ ਹੋਰ ਸੂਟ ਪਸੰਦ ਆਇਆ ਸੀਗਾ ਅਤੇ ਮੈਂ ਉਹ ਔਡਰ ਕੀਤਾ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਖੋਲ੍ਹ ਕੇ ਦਿਖਾਓ ਤਾਂ ਉਨ੍ਹਾਂ ਨੇ ਮੈਨੂੰ ਨਾ ਕਰ ਤੀ ਮੈਂ ਉਨ੍ਹਾਂ ਨੂੰ ਬੜੀ ਵਾਰੀ ਕਿਹਾ ਪਰ ਲੇਕਿਨ ਉਹ ਨਾ ਮੰਨੇ ਮੇਰੇ ਵਾਰ ਵਾਰ ਬੋਲਣ 'ਤੇ ਵੀ ਉਨ੍ਹਾਂ ਨੇ ਮੈਨੂੰ ਖੋਲ੍ਹ ਕੇ ਨਾ ਦੇਖਣ ਦਿੱਤਾ ਉਹ ਕਹਿੰਦੇ ਕਿ ਅਸੀਂ ਇਹਨੂੰ ਖੋਲ੍ਹਣ ਨਹੀਂ ਦਿੰਦੇ ਅਤੇ ਜਦੋਂ ਮੈਂ ਉਸ ਨੂੰ ਘਰ ਖੋਲਿਆ ਤਾਂ ਉਹ ਸ ਬਹੁਤ ਹੀ ਖ਼ਰਾਬ ਸੂਟ ਨਿਕਲਿਆ ਉਸ ਦਾ ਕੱਪੜਾ ਵੀ ਬੇਕਾਰ ਨਿਕਲਿਆ ਮੇਰਾ ਪਹਿਲਾ ਐਕਸਪੀਰੀਐਂਸ ਤਾਂ ਬੜਾ ਵਧੀਆ ਰਿਹਾ ਪਰ ਜਿਹੜਾ ਦੂਜਾ ਸੂਟ ਸੀ ਉਸ ਨੂੰ ਦੇਖ ਕੇ ਮੈਨੂੰ ਬੜਾ ਹੀ ਗੁੱਸਾ ਆਇਆ ਅਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਲਗਾ ਦਿੱਤਾ ਕਿ ਮੇਰਾ ਸੂਟ ਖ਼ਰਾਬ ਨਿਕਲਿਆ ਬੱਟ ਪਰ ਉਨ੍ਹਾਂ ਨੇ ਮੇਰੇ ਪੈਸੇ ਫਿਰ ਵੀ ਨਾ ਵਾਪਸ ਦਿੱਤੇ ਨਾ ਹੀ ਉਨ੍ਹਾਂ ਨੇ ਮੇਰੀ ਸੁਣੀ ਉਨ੍ਹਾਂ ਨੇ ਕਿਹਾ ਕਿ ਵਾਪਸੀ ਨਹੀਂ ਹੋਣੀ ਤਾਂ ਮੈਨੂੰ ਬੜਾ ਹੀ ਗੁੱਸਾ ਆਇਆ ਇਹ ਪਹਿਲੀ ਵਾਰ ਦੇ ਵਿੱਚ ਤਾਂ ਇਨ੍ਹਾਂ ਨੇ ਬੜਾ ਅੱਛਾ ਭੇਜਿਆ ਪਰ ਦੂਜੀ ਵਾਰ ਵਿੱਚ ਜਦੋਂ ਇੰਨ੍ਹਾਂ ਨੇ ਵਧੀਆ ਨਾ ਭੇਜਿਆ ਤਾਂ ਮੈਨੂੰ ਬੜਾ ਹੀ ਗੁੱਸਾ ਆਇਆ ਮੇਰੇ ਪੈਸੇ ਵੀ ਇੰਨ੍ਹਾਂ ਨੇ ਖ਼ਰਾਬ ਕਰ ਦਿੱਤੇ ਅਤੇ ਸੂਟ ਵੀ ਵਧੀਆ ਨਾ ਆਇਆ ਇਸ ਕਰਕੇ ਇਹ ਐਕਸਪੀਰੀਐਂਸ ਬੜਾ ਬੜਾ ਮਾੜਾ ਨਿਕਲਿਆ